ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਨੂੰ ਕੁਛ ਨਹੀਂ ਸਮਝਿਆ ਜਾਂਦਾ ਪੰਜਾਬੀ ਤਾਂ ਬਿਲਕੁਲ ਹੀ ਪੰਜਾਬ ਵਿੱਚੋਂ ਖ਼ਤਮ ਹੋ ਰਹੀ ਹੈ ਜਦ ਕਿ ਪੰਜਾਬੀ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਸੀ ਅੱਜ ਅੰਗਰੇਜ਼ੀ ਤਾਂ ਹਿੰਦੀ ਕਰਕੇ ਪੰਜਾਬੀ ਨੂੰ ਤੀਸਰੇ ਨੰਬਰ 'ਤੇ ਰੱਖਿਆ ਜਾ ਰਿਹਾ ਹੈ ਕਿਉਂਕਿ ਬੱਚੇ ਛੋਟਿਆਂ ਤੋਂ ਲੈ ਕੇ ਵੱਡਿਆਂ ਤਾਈਂ ਹਰ ਕੋਈ ਅੰਗਰੇਜ਼ੀ ਹਿੰਦੀ ਨੂੰ ਮਹੱਤਤਾ ਦਿੰਦਾ ਹੈ ਪੰਜਾਬੀ ਨੂੰ ਕੋਈ ਵੀ ਨਹੀਂ ਪੁੱਛਦਾ ਕੋਈ ਪੰਜਾਬੀ ਬੋਲਦਾ ਹੈ ਜੋਬ ਲੈਣ ਜਾਂਦਾ ਹੈ ਤਾਂ ਉਹਨੂੰ ਪੰਜਾਬੀ ਬੋਲ ਦੇ ਸਮੇਂ ਇਹ ਸੋਚਿਆ ਜਾਂਦਾ ਹੈ ਕਿ ਉਹ ਅਨਪੜ੍ਹ ਹੈ ਉਸਨੂੰ ਕੁਛ ਨਹੀਂ ਆਉਂਦਾ ਪੰਜਾਬੀ ਤੀਸਰੇ ਨੰਬਰ 'ਤੇ ਆ ਚੁੱਕੀ ਹੈ ਹਰ ਕੋਈ ਇੰਗਲਿਸ਼ 'ਚ ਅਤੇ ਹਿੰਦੀ 'ਚ ਗੱਲ ਕਰਨਾ ਚਾਹੁੰਦਾ ਹੈ ਪੰਜਾਬੀ ਵਾਸਤੇ ਬਹੁਤ ਸਾਰੀਆਂ ਚੁਣੌਤੀਆਂ ਖੜ੍ਹੀਆਂ ਹੋ ਚੁੱਕੀਆਂ ਏ ਪੰਜਾਬੀ ਪੰਜਾਬ ਵਾਲਿਆਂ ਦੀ ਸ਼ਾਨ ਸੀ ਪਰ ਅੰਗਰੇਜ਼ੀ ਇਨਸਾਨ ਨੂੰ